ਸਾਡੇ ਇਲਾਕੇ ਦੇ ਵਿੱਚ ਬਹੁਤ ਸਾਰੇ ਪ੍ਰਸਿੱਧ ਸਕੂਲ ਹਨ ਪਰ ਉਹਨਾਂ ਵਿੱਚੋਂ ਸਭ ਤੋਂ ਪ੍ਰਸਿੱਧ ਤਿਓ ਸਕੂਲ ਰਿਆਤ ਬਹਾਰਾ ਸਕੂਲ ਹੈ ਜੋ ਕਿ ਬਹੁਤ ਹੀ ਵਧੀਆ ਹੈ ਇਸਦੇ ਵਿੱਚ ਦੋਨੋਂ ਮੀਡੀਅਮ ਹਨ ਪੰਜਾਬੀ ਅਤੇ ਇੰਗਲਿਸ਼ ਮੀਡੀਅਮ ਜੇਕਰ ਕੋਈ ਵੀ ਵਿਦਿਆਰਥੀ ਪੰਜਾਬੀ ਮੀਡੀਅਮ ਜਾਂ ਇੰਗਲਿਸ਼ ਮੀਡੀਅਮ ਵਿੱਚ ਪੜ੍ਹਨਾ ਚਾਹੁੰਦਾ ਹੈ ਤਾਂ ਇਸ ਸਕੂਲ ਵਿੱਚ ਪੜ੍ਹ ਸਕਦਾ ਹੈ ਅਤੇ ਇੱਥੋਂ ਦੇ ਅਧਿਆਪਕ ਵੀ ਬਹੁਤ ਹੀ ਵਧੀਆ ਢੰਗ ਨਾਲ ਪੜ੍ਹਾਉਂਦੇ ਹਨ ਅਤੇ ਇਹ ਸਕੂਲ ਪੂਰਾ ਹੀ ਆਧੁਨਿਕ ਤਕ ਤਕਨੀਕ ਨਾਲ ਬਣਾਇਆ ਗਿਆ ਹੈ ਜਿਸ ਦੇ ਵਿੱਚ ਬੱਚਿਆਂ ਨੂੰ ਕੰਪਿਊਟਰ ਵਿੱਚ ਈ ਕਿਤਾਬਾਂ ਵੀ ਪੜ੍ਹ ਈ ਕਿਤਾਬਾਂ ਉੱਤੇ ਵੀ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਸਾਰੀਆਂ ਕਲਾਸਾਂ ਸਮਾਰਟ ਕਲਾਸਾਂ ਹਨ ਜਿਸਦੇ ਰਾਹੀਂ ਬੱਚਿਆਂ ਨੂੰ ਬਹੁਤ ਹੀ ਢੰ ਵਧੀਆ ਢੰਗ ਨਾਲ ਗਾਈਡ ਕੀਤਾ ਜਾਂਦਾ ਹੈ ਅਤੇ ਲੈਸਨਸ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਜਾਂਦਾ ਹੈ ਇਸ ਤੋਂ ਇਲਾਵਾ ਇਸ ਸਕੂਲ ਦੀ ਸਫ਼ਾਈ ਵੀ ਬਹੁਤ ਹੀ ਜ਼ਿਆਦਾ ਵਧੀਆ ਹੈ ਇੱਥੋਂ ਦੇ ਇੱਥੋਂ ਦੇ ਅਧਿਆਪਕ ਅਧਿਆਪਕਾਵਾਂ ਵੀ ਬਹੁਤ ਹੀ ਜ਼ਿਆਦਾ ਵਧੀਆ ਢੰਗ ਨਾਲ ਪ ਪੜ੍ਹਾਉਂਦੀਆਂ ਹਨ ਅਤੇ ਉਹ ਆਪ ਵੀ ਐੱਮ ਏ ਅਤੇ ਪੀ ਐੱਚ ਡੀ ਪੀ ਐੱਚ ਡੀ ਤੱਕ ਵਿੱਦਿਆ ਪ੍ਰਾਪਤ ਕੀਤੀ ਹੋਈ ਹੈ ਜਿਸ ਕਰਕੇ ਉਹਨਾਂ ਨੂੰ ਪੜ੍ਹਾਉਣ ਦਾ ਕਾਫੀ ਜ਼ਿਆਦਾ ਤਜ਼ਰਬਾ ਹੈ ਇਸ ਕਰਕੇ ਮੈਂ ਤਾਂ ਆਪਣੇ ਸ਼ਹਿਰ ਦੇ ਸਕੂਲ ਤੋਂ ਹੀ ਸੰਤੁਸ਼ਟ ਹਾਂ ਅਤੇ ਮੈਂ ਕਿਸੇ ਵੱਡੇ ਸ਼ਹਿਰ ਦੇ ਸਕੂਲ ਨੂੰ ਤਰਜੀਹ ਨਹੀਂ ਦਿੰਦੀ